ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਆ ਹਰ ਇੱਕ ਬੱਚਾ ਹੀ ਸਕੂਲ ਜਾਂਦਾ ਹੈ ਹਰ ਇੱਕ ਵਿਦਿਆਰਥੀ ਸਕੂਲ ਜਾਂਦਾ ਹੈ ਪਰ ਕਦੇ ਕਦੇ ਅਜਿਹੀਆਂ ਕਾਰਣ ਇਹੋ ਜਿਹੇ ਬਣ ਜਾਂਦੇ ਆ ਵੀ ਉਹ ਨਿਯਮਤ ਤੌਰ 'ਤੇ ਸਕੂਲ ਨਹੀਂ ਜਾ ਪਾਉਂਦੇ ਜਿਵੇਂ ਕਈਆਂ ਬੱਚਿਆਂ ਦਾ ਘਰ ਜਿਹੜਾ ਹੈ ਉਹ ਸਕੂਲ ਤੋਂ ਕਾਫ਼ੀ ਦੂਰ ਹੁੰਦਾ ਹੈ ਜਿਹਦੇ ਕਰਕੇ ਲਗਾਤਾਰ ਸਕੂਲ ਆਉਣਾ ਉਹਨਾਂ ਲਈ ਮੁਸ਼ਕਿਲ ਹੋ ਜਾਂਦਾ ਹੈ ਉਹ ਕਈ ਦਿਨ ਛੁੱਟੀਆਂ ਕਰ ਲੈਂਦੇ ਅਤੇ ਕਈ ਦਿਨ ਜਿਹੜਾ ਉਹ ਸਕੂਲ ਆ ਜਾਂਦੇ ਆ ਇਸ ਤੋਂ ਇਲਾਵਾ ਕਈਆਂ ਕੋਲ ਆਵਾਜਾਈ ਦਾ ਕੋਈ ਸਾਧਨ ਨਹੀਂ ਹੁੰਦਾ ਕਈ ਜਿਹੜੇ ਹੈਗੇ ਅਗਰ ਬੱਸਿਸ ਦੀਆਂ ਫੈਸਿਲਿਟੀਜ ਹੋਣ ਵੀ ਤਾਂ ਉਹਦਾ ਜਿਹੜਾ ਉਹ ਕਿਰਾਇਆ ਨਹੀਂ ਦੇ ਪਾਉਂਦੇ ਇਸ ਕਰਕੇ ਕੀ ਹੋਇਆ ਵਾ ਕਿ ਉਹਨਾਂ ਦੇ ਆਵਾਜਾਈ ਸਾਧਨ ਨਾ ਹੋਣ ਕਰਕੇ ਜਿਹੜਾ ਉਹ ਤਾਂ ਵੀ ਉਹਨਾਂ ਦੀ ਮੁਸ਼ਕਿਲ ਆ ਆ ਜਾਂਦੀ ਉਹਨਾਂ ਨੂੰ ਸਕੂਲ ਆਉਣ ਦੇ ਵਿੱਚ ਨਿਯਮਿਤ ਤੌਰ 'ਤੇ ਇਸ ਤੋਂ ਇਲਾਵਾ ਕਈ ਜਿਹੜੇ ਬੱਚੇ ਆ ਉਹ ਘਰ ਵਿੱਚ ਕੰਮ ਕਰਵਾਉਂਦੇ ਆ ਜਿਹਦੇ ਕਰਕੇ ਉਹ ਲਗਾਤਾਰ ਸਕੂਲ ਨਹੀਂ ਆਉਂਦੇ ਛੁੱਟੀਆਂ ਕਰਦੇ ਆ ਕਈਆਂ ਨੂੰ ਕੀ ਹੁੰਦਾ ਹੈ ਕਿ ਇਸ ਕਈ ਤਾਂ ਸਿਰਫ਼ ਮੌਸਮ ਕਰਕੇ ਨਹੀਂ ਆਉਂਦੇ ਅਗਰ ਥੋੜ੍ਹਾ ਮੌਸਮ ਖ਼ਰਾਬ ਹੋ ਜਾਂਦਾ ਹੈ ਤਾਂ ਉਹ ਜਿਹੜੇ ਆ ਛੁੱਟੀ ਕਰ ਲੈਂਦੇ ਆ ਸਕੂਲ ਨਹੀਂ ਆਉਂਦੇ ਅਤੇ ਕਈਆਂ ਨੂੰ ਸ਼ੁਰੂ ਤੋਂ ਹੀ ਇੰਨੀ ਆਦਤ ਹੁੰਦੀ ਆ ਪੀ ਬਈ ਲਗਾਤਾਰ ਸਕੂਲ ਨਹੀਂ ਜਾਣਾ ਕਈ ਐਵੇਂ ਹੀ ਛੁੱਟੀਆਂ ਕਰ ਲੈਂਦੇ ਆ ਮਤਲਬ ਕਿ ਅੱਜ ਦੇ ਸਮੇਂ ਵਿੱਚ ਬੇਸ਼ੱਕ ਸਾਰੇ ਸਕੂਲ ਜਾਂਦੇ ਆ ਪਰ ਕੋਈ ਰੈਗੂਲਰੀ ਨਿਯਮਿਤ ਤੌਰ 'ਤੇ ਜਿਹੜਾ ਵਾ ਸਕੂਲ ਨਹੀਂ ਜਾਂਦਾ ਕਈਆਂ ਦਾ ਤਾਂ ਕੋਈ ਦੂਰੀ ਕਰਕੇ ਨਹੀਂ ਜਾਂਦਾ ਕਿ ਦੂਰ ਆ ਕਿਸੇ ਕੋਲ ਆਵਾਜਾਈ ਦਾ ਸਾਧਨ ਨਹੀਂ ਹੈਗਾ ਕਿਸੇ ਨੇ ਘਰ ਵਿੱਚ ਕੰਮ ਕਰਵਾਉਣਾ ਹੁੰਦਾ ਹੈ ਘਰ ਵਿੱਚ ਮਦਦ ਕਰਨੀ ਪੈਂਦੀ ਉਹਨਾਂ ਨੂੰ ਕਈ ਜਿਹੜੇ ਆ ਮੌਸਮ ਕਰਕੇ ਨਹੀਂ ਆਉਂਦੇ ਅਤੇ ਕਈ ਜਿਹੜੇ ਆ ਉਹਨਾਂ ਦਾ ਸ਼ੁਰੂ ਤੋਂ ਇੱਦਾਂ ਹੀ ਹੁੰਦਾ ਹੈ ਕਿ ਅਸੀਂ ਜਿਹੜਾ ਵਾ ਉਹ ਸਕੂਲ ਲਗਾਤਾਰ ਨਹੀਂ ਜਾਣਾ ਕਈ ਜਿਹੜੇ ਆ ਬੱਚੇ ਉਹ ਸਕੂਲ ਲਗਾਤਾਰ ਨਹੀਂ ਜਾ ਪਾਉਂਦੇ ਉਹ ਬੋਰ ਹੋ ਜਾਂਦੇ ਆ ਜਿਸ ਕਰਕੇ ਕੀ ਕਰਦੇ ਉਹ ਛੁੱਟੀਆਂ ਕਰਦੇ ਆ ਸੋ ਬੇਸਿਕਲੀ ਇੱਦਾਂ ਹੈ ਵੀ ਕਈ ਜਿਹੜੇ ਉਹ ਮਜ਼ਬੂ ਮਜ਼ਬੂਰੀਆਂ ਕਰਕੇ ਵੀ ਸਕੂਲ ਜਾ ਪਾਉਂਦੇ ਲਗਾਤਾਰ ਅਤੇ ਕਈ ਜਿਹੜੇ ਆ ਉਹ ਸ਼ੁਰੂ ਤੋਂ ਉਹਨਾਂ ਦਾ ਇੱਦਾਂ ਹੀ ਵਿਹ ਨੇਚਰ ਬਣਿਆ ਹੁੰਦਾ ਹੈ ਕਿ ਲਗਾਤਾਰ ਸਕੂਲ ਨਹੀਂ ਜਾਂਦੇ ਉਹ